ਮੈਨੂੰ ਪੋਸਟਰ ਬਣਾਉਣਾ ਬਹੁਤ ਪਸੰਦ ਹੈ ਅਤੇ ਇਹ ਮੇਰੀ ਮਨ ਪਸੰਦ ਸ਼ੈਲੀ ਵੀ ਹੈ ਮੈਂ ਬਚਪਨ ਤੋਂ ਹੀ ਪੋਸਟਰ ਬਣਾਉਣ ਵਿੱਚ ਅਤੇ ਪੈਂਟਿੰਗ ਕਰਨ ਵਿੱਚ ਬਹੁਤ ਦਿਲਚਸਪੀ ਲੈਂਦਾ ਸੀ ਕਿਉਂਕਿ ਜਦੋਂ ਵੀ ਮੈਂ ਪੈਂਟਿੰਗ ਬਣਾਉਂਦਾ ਤਾਂ ਮੇਰਾ ਸਾਰਾ ਧਿਆਨ ਆਪਣੀ ਪੈਂਟਿੰਗ ਦੇ ਵਿੱਚ ਹੁੰਦਾ ਜਿਸ ਨਾਲ ਮੈਂ ਥੋੜ੍ਹੇ ਹੀ ਸਮੇਂ ਵਿੱਚ ਬਹੁਤ ਵਧੀਆ ਪੇਂਟਿੰਗ ਬਣਾਉਣੀ ਸਿੱਖ ਗਿਆ ਚਿੱਤਰਕਾਰੀ ਕਰਨੀ ਜਾਂ ਪੋਸਟਰ ਬਣਾਉਣਾ ਮੈਨੂੰ ਬਹੁਤ ਚੰਗਾ ਲੱਗਦਾ ਸੀ ਮੈਂ ਬਚਪਨ ਵਿੱਚ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਬਹੁਤ ਸੋਹਣਾ ਪੋਸਟਰ ਬਣਾਇਆ ਜਿਸ ਕਰਕੇ ਮੇਰੇ ਅਧਿਆਪਕਾਂ ਨੇ ਮੈਨੂੰ ਬਹੁਤ ਸ਼ਾਬਾਸ਼ ਦਿੱਤੀ ਮੈਨੂੰ ਚਿੱਤਰਕਾਰੀ ਸਿੱਖਣਾ ਇਸ ਕਰਕੇ ਵੀ ਵਧੀਆ ਲੱਗਦਾ ਹੈ ਕਿਉਂਕਿ ਮੇਰੇ ਪਿਤਾ ਜੀ ਵੀ ਬਹੁਤ ਵਧੀਆ ਪੋਸਟਰ ਬਣਾਉਂਦੇ ਹਨ ਉਹਨਾਂ ਤੋਂ ਸਿੱਖ ਕੇ ਹੀ ਮੈਂ ਇਹ ਤਕਨੀਕ ਸਿੱਖੀ ਹੈ ਜਦੋਂ ਵੀ ਮੈਂ ਵਿਹਲੇ ਸਮਾਂ ਹੁੰਦਾ ਹਾਂ ਤਾਂ ਮੈਂ ਕੁਝ ਨਾ ਕੁਝ ਬਣਾਉਣ ਬੈਠ ਜਾਂਦਾ ਹਾਂ ਅਤੇ ਆਪਣੀ ਮਿਹਨਤ ਅਤੇ ਲਗਨ ਨਾਲ ਬਹੁਤ ਵਧੀਆ ਪੋਸਟਰ ਬਣਾ ਲੈਂਦਾ ਹਾਂ ਜਿਸ ਤਰ੍ਹਾਂ ਇੱਕ ਲੇਖਕ ਨੂੰ ਆਪਣੀ ਲਿਖਤ ਦੇ ਨਾਲ ਪਿਆਰ ਹੁੰਦਾ ਹੈ ਉਸੇ ਤਰ੍ਹਾਂ ਮੈਨੂੰ ਆਪਣੀ ਚਿੱਤਰਕਾਰੀ ਦੀ ਕਲਾ ਨਾਲ ਬਹੁਤ ਪਿਆਰ ਹੈ ਮੈਂ ਜੋ ਕੁਝ ਵੀ ਸ ਮਨ ਵਿੱਚ ਸੋਚ ਲੈਂਦਾ ਹਾਂ ਉਸਨੂੰ ਬੜੇ ਹੀ ਬਿਹਤਰ ਢੰਗ ਨਾਲ ਬਣਾ ਵੀ ਦਿੰਦਾ ਹਾਂ ਜਿਸ ਨਾਲ ਮੇਰੀ ਕਲਾ ਵਿੱਚ ਨਿਰੰਤਰ ਸੁਧਾਰ ਹੁੰਦਾ ਗਿਆ ਹੈ ਮੈਂ ਅੱਜ ਤੱਕ ਕਈ ਤਰ੍ਹਾਂ ਦੀ ਪੋਸਟਰ ਬਣਾਏ ਹਨ ਜਿਹਨਾਂ ਤੋਂ ਮੈਂ ਆਪ ਵੀ ਪ੍ਰਭਾਵਿਤ ਹੋਇਆ ਹਾਂ ਕਿਉਂਕਿ ਮੈਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਮੈਂ ਇਨੇ ਚੰਗੇ ਪੋਸਟਰ ਵੀ ਬਣਾ ਲੈਂਦਾ ਹਾਂ ਇਸ ਕਰਕੇ ਮੈਂ ਇਹਨਾਂ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਲੈਂਦਾ ਹਾਂ ਮੈਂ ਇਸ ਕਰਕੇ ਵੀ ਇਸ ਵਿੱਚ ਜ਼ਿਆਦਾ ਦਿਲਚਸਪੀ ਲੈਂਦਾ ਹਾਂ ਕਿਉਂਕਿ ਇਹ ਮੇਰੇ ਵਿਹਲੇ ਸਮੇਂ ਮੈਨੂੰ ਬਿਲਕੁਲ ਜਾਇਆ ਨਹੀਂ ਹੋਣ ਦਿੰਦੀ ਅਤੇ ਵਾਧੂ ਸਮੇਂ ਦਾ ਸਹੀ ਪ੍ਰਯੋਗ ਕਰਨਾ ਹੋਵੇ ਤਾਂ ਚਿੱਤਰਕਾਰੀ ਕਰਨ ਤੋਂ ਇਲਾਵਾ ਬਿਹਤਰ ਆਪਸ਼ਨ ਹੋਰ ਕੋਈ ਨਹੀਂ ਹੋ ਸਕਦੀ ਇਸ ਕਰਕੇ ਮੈਂ ਚਿੱਤਰਕਾਰੀ ਕਰਨਾ ਬਹੁਤ ਵਧੀਆ ਮੰਨਦਾ ਹਾਂ